ਹੈਲੋ ਸਤਿ ਸ਼੍ਰੀ ਅਕਾਲ ਬੂਮੀ ਕਿਵੇਂ ਹੋ ਮੈਂ ਵੀ ਵਧੀਆ ਹਾਂਜੀ ਮੈਂ ਵੀ ਆਪਣੇ ਬੇਟੇ ਨੂੰ ਥੋੜ੍ਹੇ ਦਿਨ ਦਿਨਾਂ ਪਹਿਲੇ ਮੈਂ ਵੀ ਆਪਣੇ ਬੇਟੇ ਨੂੰ ਜੇ ਐਮ ਕੇ 'ਚ ਪਾਇਆ ਹੈ ਸਕੂਲ ਚੇਂਜ ਕੀਤਾ ਮੈਂ ਵੀ ਉਹਦਾ ਅਤੇ ਪਠਾਨਕੋਟ ਦਾ ਟੋਪ ਸਕੂਲਜ਼ ਹਨ ਜਿਵੇਂ ਕਿ ਹੋ ਗਿਆ ਜੇ ਐਮ ਕੇ ਹੋ ਗਿਆ ਪ੍ਰਤਾਪ ਵਰਲਡ ਹੋ ਗਿਆ ਐਮ ਸੀ ਐਸ ਹੋ ਗਿਆ ਤੁਸੀਂ ਉਹਨੂੰ ਉੱਥੇ ਵੀ ਪਾ ਸਕਦੇ ਹੋ ਅਤੇ ਮੈਂ ਤਾਂ ਜੇ ਐਮ ਕੇ ਹੀ ਪ੍ਰੈਫਰ ਕੀਤਾ ਹੈ ਉਹਨੂੰ ਖਰਚੇ ਬਾਰੇ ਤਾਂ ਇਹ ਹੈ ਕਿ ਜੇ ਤੁਸੀਂ ਐਡਮਿਸ਼ਨ ਕਰਾਉਣੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਐਂਟਰੈਂਸ ਟੈਸਟ ਦੇਣਾ ਪਵੇਗਾ ਉਹਦੇ ਵਿੱਚ ਤੁਹਾਨੂੰ ਮਤਲਬ ਜਿਤਨਾ ਵੀ ਓਵਰਆਲ ਸਿਲੇਬਸ ਹੈ ਤੁਹਾਨੂੰ ਉਹ ਸਾਰਾ ਆਵੇਗਾ ਤੁਹਾਡੇ ਬੇਟੇ ਨੂੰ ਅਤੇ ਉਸ ਤੋਂ ਬਾਅਦ ਖਰਚੇ ਬਾਰੇ ਇਹ ਹੈ ਕਿ ਟੋਟਲ ਬੋਡਿੰਗ ਦਾ ਮਿਲਾ ਕੇ ਅਤੇ ਬੱਸ ਦਾ ਖਰਚਾ ਮਿਲਾ ਕੇ ਤੁਹਾਨੂੰ ਦਸ ਹਜ਼ਾਰ ਤੱਕ ਫੀਸ ਹੋਵੇਗੀ ਉਸ ਚੀਜ਼ ਦੀ ਹਾਂਜੀ ਵੋ ਉਹ ਤੁਹਾਨੂੰ ਸਕੂਲੋਂ ਹੀ ਮਿਲੇਗਾ ਜਿਹੜਾ ਫੋਰਮ ਫਿੱਲ ਕਰਨਾ ਹੈ ਅਤੇ ਜਿਹੜਾ ਟੈਸਟ ਦੇਣਾ ਉਹ ਟੈਸਟ ਦੇਣ ਤੋਂ ਪਹਿਲਾਂ ਹੀ ਤੁਸੀਂ ਫੋਰਮ ਫਿੱਲ ਕਰੋਗੇ ਅਤੇ ਉਸ ਤੋਂ ਬਾਅਦ ਤੁਹਾਡੇ ਬੇਟੇ ਦਾ ਟੈਸਟ ਹੋਵੇਗਾ ਉੱਥੇ ਹੀ ਫਿਰ ਉਸ ਤੋਂ ਬਾਅਦ ਤੁਹਾਨੂੰ ਮਤਲਬ ਐਨਟ੍ਰੀਗਲੀ ਕੇ ਜੀ ਕਾਲ ਆ ਜਾਵੇਗੀ ਹਾਂ ਠੀਕ ਹੈ ਜੀ ਓਕੇ